ਉਹਨਾਂ ਨੂੰ ਗਤਾਵਾ ਵੀ ਪਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਚੋਖਰ ਫੀਡ ਦੀ ਜਿਹੜੀ ਆ ਉਹ ਵਧੀਆ ਵਧੀਆ ਕਿਸਮ ਦੀ ਜਿਹੜੀ ਆ ਉਹ ਖਿਲਾਉਣੀ ਚਾਹੀਦੀ ਹੈ ਅਤੇ ਉਹਨਾਂ ਦਾ ਮੈਡੀਕਲ ਚੈੱਕਅਪ ਵੀ ਸਮੇਂ ਸਮੇਂ 'ਤੇ ਉਹਨਾਂ ਨੂੰ ਮੈਡੀਕਲ ਚੈਕਅਪ ਵੀ ਕਰਵਾਉਣਾ ਚਾਹੀਦਾ ਤਾਂਜੋ ਜਿਹੜਾ ਹੈ ਦੁੱਧ ਦੇ ਫੈਟ ਨੂੰ ਵਧਾਇਆ ਜਾ ਸਕੇ ਵਧੀਆ ਦੁੱਧ ਜਿਹੜਾ ਆ ਉਹ ਦੇ ਸਕੇ ਦੁੱਧ ਦੀ ਫੈਟ ਨੂੰ ਵਧਾਉਣ ਲਈ ਇਹੀ ਹੈ ਕਿ ਕਿਉਂਕਿ ਦੁੱਧ ਦੇਣ ਵਾਲਾ ਇੱਕ ਪਸ਼ੂ ਹੁੰਦਾ ਹੈ ਅਤੇ ਪਸ਼ੂ ਦੀ ਕੇਅਰ ਹੋਏਗੀ ਅਤੇ ਦੁੱਧ ਜਿਹਦੀ ਫੈਟ ਵਿੱਚ ਜਿਹੜੇ ਆ ਦੁੱਧ ਦੀ ਫੈਟ ਆਏਗੀ ਇਸ ਕਾਰਨ ਸਾਨੂੰ ਪਸ਼ੂਆਂ ਦੀ ਸਮੇਂ ਸਮੇਂ 'ਤੇ ਦੇਖਭਾਲ ਕਰਨੀ ਚਾਹੀਦੀ ਆ ਉਹਨਾਂ ਨੂੰ